ਹਾਂਜੀ ਸਿਲਾਈ ਕਢਾਈ ਦਾ ਕੰਮ ਤਾਂ ਮੈਂ ਕਰ ਹੀ ਲੈਂਦੀ ਹਾਂ ਮੈਨੂੰ ਕਾਫੀ ਹੱਦ ਤੱਕ ਇਹ ਕੰਮ ਆਉਂਦਾ ਹੈ ਪਰ ਜਦੋਂ ਮੈਂ ਫਰਾਕ ਸੂਟ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਉਹਦੇ ਉਸ ਨੂੰ ਬਣਾਉਣ ਦੇ ਵਿੱਚ ਕਾਫੀ ਦਿੱਕਤਾਂ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਉਸ ਦੇ ਆਕਾਰ ਨੂੰ ਲੈ ਕੇ ਉਸ ਦੇ ਨਾਪ ਨੂੰ ਲੈ ਕੇ ਉਸ ਦੇ ਸਾਈਜ਼ ਨੂੰ ਲੈ ਕੇ ਮੈਨੂੰ ਕਾਫੀ ਸ ਸਮੱਸਿਆਵਾਂ ਆਈਆਂ ਪਰ ਮੈਂ ਇਸ ਨੂੰ ਕਿਸੇ ਤਰੀਕੇ ਦੇ ਨਾਲ ਇੱਧਰੋਂ ਉੱਧਰੋਂ ਪੁੱਛ ਕੇ ਫੋਨ 'ਚੋਂ ਦੇਖ ਕੇ ਲੋਕਾਂ ਕੋਲੋਂ ਉਹਨਾਂ ਦੀਆਂ ਫਰਾਕ ਲੈ ਕੇ ਉਹਨਾਂ ਦਾ ਨਾਪ ਲੈ ਕੇ ਉਸ ਨੂੰ ਕੱਟ ਵੱਢ ਕੇ ਮੈਂ ਇਸ ਨੂੰ ਪੂਰਾ ਕਰ ਹੀ ਲਿਆ ਜਿਸ ਨਾਲ ਮੈਨੂੰ ਬੜੀ ਖੁਸ਼ੀ ਹੋਈ ਅਤੇ ਇਸ ਕਰਕੇ ਮੇਰੀ ਬੁਣਾਈ ਦੇ ਵਿੱਚ ਜੋ ਵੀ ਸ਼ੌਕ ਸੀ ਉਹ ਅੱਗੇ ਨਾਲੋਂ ਜ਼ਿਆਦਾ ਹੋਰ ਵੱਧ ਰਹੇ ਹਨ ਅਤੇ ਮੈਂ ਇਸਨੂੰ ਹੋਰ ਵੀ ਵਧਾਉਂਗੀ